ਸਤਿ ਸ਼੍ਰੀ ਅਕਾਲ ਜੀ ਮੈਂ ਮਹੀਨਾ ਪਹਿਲਾਂ ਤੁਹਾਡੇ ਤੋਂ ਇੱਕ ਪ੍ਰੈੱਸ ਔਡਰ ਕਰਵਾਈ ਸੀਗੀ ਪਹਿਲੀ ਗੱਲ ਤਾਂ ਉਹ ਜਦੋਂ ਟਾਈਮ ਦਿੱਤਾ ਹੋਇਆ ਸੀ ਉਹ ਟਾਈਮ 'ਤੇ ਪਹੁੰਚੀ ਨਹੀਂ ਹੈਗੀ ਅਤੇ ਡਿਲੀਵਰੀ ਬੁਆਏ ਇੰਨਾਂ ਜ਼ਿਆਦਾ ਲੇਟ ਆਇਆ ਕਿ ਬਸ ਪੁੱਛੋ ਨਾ ਜਦੋਂ ਅਸੀਂ ਪ੍ਰੈੱਸ ਦੇਖੀ ਤਾਂ ਪ੍ਰੈੱਸ ਦੀ ਜਿਹੜੀ ਪੈਕਿੰਗ ਇੰਨੀ ਘਟੀਆ ਕੀਤੀ ਹੋਈ ਸੀ ਨਾ ਵੀ ਦੇਖਣ ਨੂੰ ਵੀ ਦਿਲ ਨਹੀਂ ਸੀ ਕਰਦਾ ਉਸ ਤੋਂ ਬਾਅਦ ਜਦੋਂ ਪ੍ਰੈੱਸ ਖੋਲ੍ਹਕੇ ਦੇਖੀ ਤਾਂ ਜੋ ਅਸੀਂ ਕਲਰ ਮੰਗਵਾਇਆ ਸੀ ਉਹ ਕਲਰ ਤਾਂ ਹੈ ਹੀ ਨਹੀਂ ਸੀ ਅਸੀਂ ਰੈੱਡ ਕਲਰ ਮੰਗਵਾਇਆ ਸੀ ਪਰ ਇਹਨਾਂ ਨੇ ਚੱਕ ਕੇ ਕੋਈ ਹੋਰ ਹੀ ਕਲਰ ਭੇਜ ਦਿੱਤਾ ਜੋ ਕਿ ਦੇਖਣ ਨੂੰ ਵੀ ਬਿਲਕੁਲ ਹੀ ਸੋਹਣਾ ਨਹੀਂ ਸੀ ਲੱਗਦਾ ਅਤੇ ਸੈਂਕਿੰਡ ਗੱਲ ਆ ਜਾਂਦੀ ਯੂਜ਼ ਕਰਨ ਦੀ ਜਦੋਂ ਅਸੀਂ ਯੂਜ਼ ਕਰਕੇ ਵੇਖਿਆ ਤਾਂ ਇਹ ਤਾਂ ਗਰਮ ਹੋਣ 'ਚ ਨਹੀਂ ਆਈ ਹੈਗੀ ਬਿਲਕੁਲ ਵੀ ਨਹੀਂ ਗਰਮ ਹੋਈ ਬਹੁਤ ਦੇਰ ਬਾਅਦ ਗਰਮ ਹੋਈ ਜਦੋਂ ਗਰਮ ਹੋ ਗਈ ਉਹ ਤੋਂ ਬਾਅਦ ਅਸੀਂ ਪ੍ਰੈੱਸ ਕਰਨ ਦੀ ਕੋਸ਼ਿਸ਼ ਕੀਤੀ ਕੱਪੜੇ ਬਿਲਕੁਲ ਚੰਗੀ ਤਰ੍ਹਾਂ ਪ੍ਰੈੱਸ ਨਹੀਂ ਕੀਤੇ ਅਤੇ ਉਸ ਤੋਂ ਬਾਅਦ ਠੰਡੀ ਹੋਣ 'ਚ ਹੀ ਨਹੀਂ ਆਈ ਹੈਗੀ ਇਹ ਅਤੇ ਇਸਦੇ ਨਾਲ਼ ਜਿਹੜੇ ਵਾਇਰ ਲੱਗੀ ਹੋਈ ਸੀ ਉਹ ਤਾਂ ਇੰਨੀ ਜ਼ਿਆਦਾ ਘਟੀਆ ਕੋਆਲਿਟੀ ਦੀ ਸੀ ਨਾ ਅਤੇ ਉਹਨੂੰ ਮਾੜਾ ਜਿਹਾ ਖਿੱਚਣ ਦੀ ਕੋਸ਼ਿਸ਼ ਕਰਦੇ ਉਹ ਟੁੱਟ ਜਾਣੀ ਸੀ ਅਤੇ ਕਰੰਟ ਲੱਗਣ ਦਾ ਵੀ ਬਹੁਤ ਜ਼ਿਆਦਾ ਖ਼ਤਰਾ ਸੀਗਾ ਅਤੇ ਤੀਸਰੀ ਗੱਲ ਉਹ ਬਿਜਲੀ ਇੰਨੀ ਜ਼ਿਆਦਾ ਖਿੱਚਦੀ ਸੀ ਬਹੁਤ ਜ਼ਿਆਦਾ ਜਿਹਦੇ ਨਾਲ਼ ਕਿ ਬਿੱਲ 'ਤੇ ਵੀ ਬਹੁਤ ਜ਼ਿਆਦਾ ਪ੍ਰਭਾਵ ਪਿਆ ਇਸ ਗੱਲ ਦਾ ਅਤੇ ਇੰਨੀ ਘਟੀਆ ਪ੍ਰੈੱਸ ਅਸੀਂ ਅੱਜ ਤੱਕ ਨਹੀਂ ਦੇਖੀ ਹੈਗੀ ਅਤੇ ਅਸੀਂ ਇਹ ਹੀ ਤੁਹਾਨੂੰ ਰੀਕੁਐਸਟ ਕਰਦੇ ਹਾਂ ਜਾਂ ਤਾਂ ਸਾਡਾ ਰੀਫੰਡ ਕਰੋ ਜਾਂ ਸਾਨੂੰ ਜਿਹੜੀ ਅਸਲੀ ਓਰੀਜਨਲ ਪ੍ਰੈੱਸ ਹੈ ਉਹ ਸਾਨੂੰ ਭੇਜਣ ਦੀ ਕ੍ਰਿਪਾਲਤਾ ਕਰੋ ਜੀ ਧੰਨਵਾਦ